ਘਰ ਵਿੱਚ ਤੁਲਸੀ ਅਤੇ ਜੜ੍ਹੀ ਬੂਟੀਆਂ ਦੀ ਵਰਤੋਂ ਹੁੰਦੀ ਰਹਿੰਦੀ ਹੈ ਕਿਉਂਕਿ ਸਰਦੀ ਵਿੱਚ ਚਾਹ ਵਿੱਚ ਤੁਲਸੀ ਉਬਾਲ ਕੇ ਪੀਣੀ ਹੈ ਤਾਂ ਅਸੀਂ ਘਰ ਵਿੱਚ ਉਗਾ ਕੇ ਅਸੀਂ ਤੁਲਸੀ ਤੋੜ ਕੇ ਤਾਜ਼ੀ ਤੁਲਸੀ ਦਾ ਪੱਤਾ ਅਸੀਂ ਪਾ ਕੇ ਚਾਹ ਬਣਾ ਕੇ ਪੀ ਸਕਦੇ ਹਾਂ ਇਹ ਜੜੀ ਬੂਟੀਆਂ ਵਰਗਾ ਕੰਮ ਕਰਦੀ ਆ ਹੋਰ ਵੀ ਕਈ ਇਹੋ ਜਿਹੇ ਪੌਦੇ ਨੇ ਜਿਹੜੇ ਸਾਨੂੰ ਜੜੀ ਬੂਟੀਆਂ ਦਾ ਕੰਮ ਕਰਦੇ ਹਨ ਜਿਵੇਂ ਨਿੰਮ ਹੋ ਗਈ ਨਿੰਮ ਦਾ ਅਸੀਂ ਬਹੁਤ ਵਧੀਆ ਫ਼ਾਇਦਾ ਲੈ ਸਕਦੇ ਹਾਂ ਅਤੇ ਹੋਰ ਵੀ ਪੌਦੇ ਬਹੁਤ ਨੇ ਜਿਵੇਂ ਹੁਣ ਸਬਜ਼ੀਆਂ ਨੇ ਬਾਹਰੋਂ ਲੈਣ ਜਾਣਾ ਉਹ ਦਿੱਕਤ ਆਉਂਦੀ ਹੈ ਘਰ ਉਗਾਈਆਂ ਜਾਂਦੀਆਂ ਨੇ ਘਰ ਨਾਲੇ ਹਰਿਆਲੀ ਦਾ ਕੰਮ ਕਰਦੀਆਂ ਨੇ ਨਾਲੇ ਪੌਦਿਆਂ ਦਾ ਕੰਮ ਹੋ ਜਾਂਦਾ ਹੈ ਸਾਡੇ ਘਰ ਵਿੱਚ ਵੀ ਕਾਫ਼ੀ ਪੌਦੇ ਲੱਗੇ ਨੇ ਨਿੰਮ ਦਾ ਟਮਾਟਰ ਦਾ ਅਦਰਕ ਦ ਲਸਣ ਦਾ ਕਈ ਪੌਦੇ ਲੱਗੇ ਨੇ ਜਿਹੜੇ ਅਸੀਂ ਤੋੜ ਕੇ ਤਾਜ਼ੇ ਵਰਤਦੇ ਹਾਂ ਅਤੇ ਉਹਨਾਂ ਦਾ ਬਹੁਤ ਵਧੀਆ ਫ਼ਾਇਦਾ ਹੁੰਦਾ ਹੈ ਇਹ ਕੁਦਰਤੀ ਚੀਜ਼ ਹੈ ਜਿਹੜੀ ਸਾਨੂੰ ਬਿਨ੍ਹਾਂ ਗੰਦਗੀ ਬਿਨ੍ਹਾਂ ਟੀਕਿਆਂ ਤੋਂ ਮਿਲ ਜਾਂਦੀ ਹੈ ਘਰ ਬਿਨ੍ਹਾਂ ਦਵਾਈਆਂ ਤੋਂ